ਹੈਲੋ ਵੀਰੇ ਮੇਰਾ ਨਾਂ ਮਨਪ੍ਰੀਤ ਸਿੰਘ ਹੈ ਕੀ ਤੁਸੀਂ ਐਮਾਜੋਨ ਕਸਟਮਰ ਕੇਅਰ ਤੋਂ ਗੱਲ ਕਰਦੇ ਹੋ ਮੈਂ ਆਪਣੇ ਐਮਾਜੋਨ ਤੋਂ ਹੈੱਡਫ਼ੋਨ ਆਡਰ ਕਰੇ ਸੀਗੇ ਉਹਨਾਂ ਨੇ ਮੈਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਸੀਗਾ ਅੱਜ ਚਾਰ ਦਿਨ ਹੋ ਗਏ ਆਡਰ ਕਰਿਆਂ ਨੂੰ ਅਤੇ ਮੇਰੇ ਕੋਲ ਪਹੁੰਚੇ ਨੀਗੇ ਹੈੱਡਫ਼ੋਨ ਤਾਂ ਮੇਰੇ ਕੋਲ ਸਮਾਂ ਘੱਟ ਹੋਣ ਕਾਰਣ ਬਜ਼ਾਰ ਜਾਣ ਦਾ ਸਮਾਂ ਨਹੀਂ ਸੀਗਾ ਤਾਂ ਕਰਕੇ ਮੈਂ ਐਮਾਜੋਨ ਤੋਂ ਆਡਰ ਕਰੇ ਸੀਗੇ ਅਤੇ ਉਹ ਹਜੇ ਤੱਕ ਪਹੁੰਚ ਨਹੀਂ ਪਹੁੰਚੇ ਨੀਗੇ ਕਿ ਤੁਸੀਂ ਆਪਣੇ ਡਿਲੀਵਰੀ ਬੋਆਏ ਨੂੰ ਪੁੱਛ ਸਕਦੇ ਹੋ ਵੀ ਆਡਰ ਕਿੱਥੇ ਰੁੱਕ ਗਿਆ ਪੁ ਜੇ ਅੱਗੇ ਤੋਂ ਮੇਰੀ ਐਮਾਜੋਨ ਤੋਂ ਕੋਈ ਵੀ ਡਿਲੀਵਰੀ ਲੇਟ ਆਉਂਦੀ ਹੈ ਤਾਂ ਮੈਂ ਉਹ ਅੱਧੀ ਪੇਮੈਂਟ ਹੀ ਦੇਊਂਗਾ ਟੈਮ 'ਤੇ ਡਿਲੀਵਰੀ ਹੋ ਜਾਵੇ ਹੋ ਜਾਵੇ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ